ਮੈਂ ਧਾਰਮਿਕ ਸਥਾਨਾਂ ਉੱਪਰ ਅਕਸਰ ਘੁੰਮਦਾ ਰਹਿੰਦਾ ਹਾਂ ਅਤੇ ਉੱਥੇ ਅਕਸਰ ਹੀ ਉਹਨਾਂ ਨਜ਼ਾਰਿਆਂ ਨੂੰ ਕੈਦ ਕਰਨਾ ਮੇਰਾ ਸ਼ੌਕ ਹੈ ਮੇਰੇ ਫੋਨ ਦਾ ਕੈਮਰਾ ਅਤੇ ਮੇਰਾ ਖੁਦ ਦਾ ਪਰਸਨਲ ਕੈਮਰਾ ਜੋ ਕਿ ਮੇਰੇ ਹਮੇਸ਼ਾ ਨਾਲ ਹੀ ਰਹਿੰਦਾ ਹੈ ਅਤੇ ਮੈਂ ਉਹਨਾਂ ਯਾਤਰਾਵਾਂ 'ਤੇ ਜਾ ਕੇ ਉਹਨਾਂ ਨਜ਼ਾਰਿਆਂ ਨੂੰ ਉਹਨਾਂ ਇਤਿਹਾਸਿਕ ਚੀਜ਼ਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਾ ਹਾਂ ਮੈਂ ਪੰਜਾਬ ਦੇ ਬਹੁਤ ਹੀ ਇਤਿਹਾਸਿਕ ਜਗ੍ਹਾਵਾਂ ਅੰਮ੍ਰਿਤਸਰ ਬਠਿੰਡਾ ਜੋ ਕਿ ਜ਼ਿਆਦਾ ਫੇਮਸ ਹਨ ਅਕਸਰ ਜਾਂਦਾ ਰਹਿੰਦਾ ਹਾਂ ਮੇਰਾ ਇਲਾਕਾ ਵੀ ਹੈ ਅਤੇ ਮੈਨੂੰ ਉੱਥੇ ਘੁੰਮਣ ਦਾ ਸ਼ੌਕ ਵੀ ਹੈ ਅੰਮ੍ਰਿਤਸਰ ਸ਼ਹਿ ਸ਼ਹਿਰ ਦੇ ਵਿੱਚ ਬਹੁਤ ਕੁਛ ਦੇਖਣ ਨੂੰ ਮਿਲਦਾ ਹੈ